ਸਾਡੇ ਪੰਜਾਬ ਵਿੱਚ ਲੋਕ ਇਲੈਕਸ਼ਨਾਂ ਲੜਨ ਜਾ ਰਹੇ ਹਨ ਜਿਵੇਂ ਕਿ ਸਾਡੇ ਪੰਜਾਬ ਵਿੱਚ ਬਹੁਤ ਸਾਰੀਆਂ ਇਲੈਕਸ਼ਨਾਂ ਹੁੰਦੀਆਂ ਹਨ ਜਿਵੇਂ ਕਿ ਹੱਥ ਪੰਜਾ ਹੱਥ ਪੰਜਾ ਹਾਥੀ ਤੱਕੜੀ ਅਕਾਲੀ ਦਲ ਹੁੰਦੇ ਹਨ ਠੀਕ ਹੈ ਜੀ ਇਹ ਬਹੁਤ ਵਧੀਆ ਇਹ ਬਹੁਤ ਵਧੀਆ ਹੀ ਇਲੈਕਸ਼ਨਾਂ ਲੜਦੇ ਹਨ ਠੀਕ ਹੈ ਇਲੈਕਸ਼ਨਾਂ ਲੜਦੇ ਹਨ ਅਤੇ ਇੱਕ ਇੱਕ ਮੈਂਬਰ ਮੈਨੂੰ ਇਸ ਇਸ ਇਲੈਕਸ਼ਨਾਂ ਵਿੱਚ ਇੱਕ ਇੱਕ ਮੈਂਬਰ ਬਹੁਤ ਵਧੀਆ ਲੱਗਿਆ ਉਹ ਇੱਕ ਖਿਡਾਰੀ ਹੈ ਉਸ ਨੇ ਪੰਜਾਬ ਨਾਲ ਵਾਅਦਾ ਕੀਤਾ ਵੀ ਮੈਂ ਇਹ ਜ਼ਿਲ੍ਹਾ ਨਵਾਂਸ਼ਹਿਰ ਤਹਿਸੀਲ ਬਲਾਚੋਰ ਵਿੱਚ ਇੱਕ ਪਿੰਡ ਰੈਲ ਮਾਜਰੇ ਵਿੱਚ ਇੱਕ ਗਰਾਊਂਡ ਬਣਾਉਣ ਜਾ ਰਿਹਾ ਹਾਂ ਤਾਂ ਉਹ ਵੀ ਇੱਕ ਖਿਡਾਰੀ ਹੈ ਤਾਂ ਉਸਨੇ ਕਿਹਾ ਵੀ ਮੈਂ ਇੱਕ ਗਰਾਊਂਡ ਬਣਾਊਂਗਾ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਮੇਰੀ ਵੀ ਵੋਟ ਬਣ ਗਈ ਹੈ ਇਸ ਸਾਲ ਅਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਇਸ ਨੂੰ ਹੀ ਮੈਂ ਵੋਟ ਪਾਵਾਂ ਵੀ ਤਾਂ ਇਹ ਤਾਂ ਮੈਨੂੰ ਇਹ ਤਾਂ ਮੈਨੂੰ ਵਧੀਆ ਲੱਗਿਆ ਵੀ ਇਹ ਗਰਾਊਂਡ ਬਣਾਊਂਗਾ ਤਾਂ ਮੈਨੂੰ ਵੀ ਖੇਡਣ ਮਿਲੂੰਗਾ ਤਾਂ ਉਹ ਵੀ ਖਿਡਾਰੀ ਹੈ ਤਾਂ ਉਹ ਵੀ ਖੇਲਣ ਆਊਂਗਾ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ